ਕੁਝ ਸਥਾਨਕ ਰਿਹਾਇਸ਼ੀ ਵਿਕਲਪ ਇਹ ਹਨ ਜਿਵੇਂ ਕਿ ਆਸ਼ੀਰਵਾਦ ਹੋਟਲ ਭੱਠਾ ਸਾਹਿਬ ਦੇ ਕੋਲ ਹੈ ਜਿਸ ਦਾ ਕਿਰਾਇਆ ਪੰਜ ਸੌ ਰੁਪਏ ਤੋਂ ਸ਼ੁਰੂ ਹੈ ਐੱਚ ਐੱਮ ਟੀ ਰਿਜ਼ੋਰਟ ਉਹੀ ਕੈਫੇ ਉਹੀ ਬਾਰ ਬਾਈਪਾਸ ਦੇ ਕੋਲ ਹੈ ਛੋਟੇ ਘਰਾਂ ਦਾ ਕਿਰਾਇਆ ਸ਼ੁਰੂ ਹੈ ਦੋ ਹਜ਼ਾਰ ਰੁਪਏ ਤੋਂ ਪੈਂਤੀ ਸੌ ਰੁਪਏ ਜਿਸ ਵਿੱਚ ਦੋ ਕਮਰੇ ਇੱਕ ਲੌਬੀ ਅਤੇ ਇੱਕ ਰਸੋਈ ਹੈ ਬਾਜ ਹੋਟਲ ਪੁਰਾਣਾ ਬੱਸ ਸਟੈਂਡ ਕੰਮ ਕਰਨ ਵਾਲੇ ਸਾਹਿਲ ਹੋਟਲ ਕੰਮ ਕਰਨ ਵਾਲੇ ਬੱਚੇ ਸਿੱਖਿਆ ਵਾਲੇ ਬੱਚੇ ਸਟੂਡੈਂਟ ਇੱਥੋਂ ਬੱਸ ਵੀ ਲੈ ਕ ਲੈ ਜਾ ਸਕਦੇ ਹਨ ਅਤੇ ਰਿਹਾਇਸ਼ ਵੀ ਕਰ ਸਕਦੇ ਹਨ